ਪੰਜਾਬੀ ਭਾਸ਼ਾ ਪੰਜਾਬ ਰਾਜ ਦੇ ਸੱਭਿਆਚਾਰਕ ਪੰਜਾਬ ਬਹੁਤ ਬੜੀ ਨ ਭੂਮਿਕਾ ਨਿਭਾਉਂਦੀ ਹੈ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਉੱਨੀ ਸੌ ਸਤਾਹਟ ਈਸਵੀ ਵਿੱਚ ਹੋਈ ਸੀ ਅਤੇ ਉੱਨੀ ਸੌ ਅਠਾਹਠ ਵਿੱਚ ਸਾਡੀ ਪੰਜਾਬ ਸਰਕਾਰ ਨੇ ਸਾਡੀ ਪੰਜਾਬੀ ਭਾਸ਼ਾ ਨੂੰ ਲਾਗੂ ਕਰ ਦਿੱਤਾ ਗਿਆ ਸਾਡੀ ਪੰਜਾਬੀ ਭਾਸ਼ਾ ਸਕੂਲ ਬੱਚਿਆਂ ਨੂੰ ਸਕੂਲ ਤੋਂ ਹੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ ਇਹ ਸਾਡੀ ਮੁੱਖ ਭਾਸ਼ਾ ਹੈ ਜਿਸ ਕਾਰਨ ਸਾਡੀ ਸੱਭਿਆਚਾਰ ਨੂੰ ਸਮਝਣ ਲਈ ਇਹ ਸਭ ਤੋਂ ਬੜੀ ਵੱਡੀ ਜ਼ਰੂਰਤ ਬਣ ਚੁੱਕੀ ਹੈ ਅਤੇ ਇਹ ਸਾਡੇ ਮਾਤਰ ਭਾਸ਼ਾ ਹੈ ਜਿਸ ਨੂੰ ਸਮਝਣ ਦੇ ਬਿਨਾਂ ਅਸੀਂ ਆਪਣੇ ਗੁਰੂਆਂ ਬਾਰੇ ਨਹੀਂ ਸਮਝ ਸਕਦੇ ਸਾਡੇ ਗੁਰੂਆਂ ਪੰਜਾਬੀ ਭਾਸ਼ਾ ਸਾਡੇ ਗੁਰੂਆਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੰਜਾਬੀ ਦੀ ਹੀ ਵਰਤੋਂ ਕੀਤੀ ਗਈ ਹੈ ਸਾਡੇ ਮੁੱਖ ਕਵੀ ਸ਼੍ਰੀ ਕਬੀਰ ਦਾਸ ਸ਼੍ਰੀ ਬੁੱਲੇ ਸ਼ਾਹ ਵਰਗੇ ਮਹਾਨ ਸ਼ਖਸੀਅਤਾਂ ਨੇ ਵੀ ਪੰਜਾਬੀ ਵਿੱਚ ਹੀ ਆਪਣੀਆਂ ਸ਼ਾਇਰੀਆਂ ਦਿੱਤੀਆਂ ਹਨ ਇਸ ਕਾਰਨ ਉਹਨਾਂ ਨੂੰ ਸਮਝਣ ਲਈ ਵੀ ਸਾਨੂੰ ਪੰਜਾਬੀ ਦੀ ਵਹੀ ਵਰਤੋਂ ਕਰਨੀ ਪੈਂਦੀ ਹੈ ਅੱਛਾ ਪੰਜਾਬੀ ਭਾਸ਼ਾ ਸਾਡੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਲਿਪੀ ਗੁਰਮੁਖੀ ਦੀ ਦੇਣ ਹਨ ਜਿਸ ਕਾਰਨ ਸਾਡੀ ਪੰਜਾਬੀ ਭਾਸ਼ਾ ਸਾਡੇ ਵਿਰਸੇ ਦਾ ਬਹੁਤ ਵੱਡਾ ਅੰਗ ਬਣ ਚੁੱਕੇ ਹਨ ਸਾਡੀ ਪੰਜਾਬੀ ਭਾਸ਼ਾ ਨੂੰ ਸਮਝਣ ਲਈ ਸਾਨੂੰ ਆਪਣੇ ਸੱਭਿਆਚਾਰਕ ਸਾਡੇ ਕਲਚਰ ਸਾਡੇ ਲੋਹੜੀ ਸਾਡੇ ਵਰਗੇ ਪਾਵਨ ਤਿਉਹਾਰ ਸਾਰੇ ਸਾਡੇ ਸਾਡੇ ਸਿਰ ਵਿਰਸੇ ਨੂੰ ਹੀ ਕਰਦੇ ਹਨ ਜਿਸ ਕਾਰਨ ਸਾਡੀ ਪੰਜਾਬੀ ਭਾਸ਼ਾ ਸਾਡੇ ਅੰਗ ਅੰਗ ਵਿੱਚ ਹੈ ਸਾਨੂੰ ਪੰਜਾਬੀ ਭਾਸ਼ਾ ਨਾਲ ਹੀ ਅਸੀਂ ਆਪਣੇ ਸਾਰੇ ਵਿਰਸਿਆਂ ਨੂੰ ਹੀ ਸਮਝ ਸਕਦੇ ਹਨ ਆਪਣੀ ਗੁਰੂਆਂ ਬਾਰੇ ਪੜ੍ਹ ਸਕਦੇ ਹਨ ਆਪਣੇ ਗੁਰੂਆਂ ਦੀ ਇਤਿਹਾਸ ਨੂੰ ਸਮਝ ਸਕਦੇ ਹਨ ਸਾਨੂੰ ਆਪਣੇ ਗੁਰੂਆਂ ਦੇ ਬੱਚਿਆਂ ਬਾਰੇ ਸਭ ਕੁਝ ਸਾਨੂੰ ਨੋਲੇਜ ਸਾਡੀ ਪੰਜਾਬੀ ਭਾਸ਼ਾ ਹੀ ਦਿੰਦੀ ਹੈ ਸਾਡੇ ਵਿਰਸੇ ਬਾਰੇ ਸਾਡੇ ਇਤਿਹਾਸ ਬਾਰੇ ਸਾਡੀ ਪੰਜਾਬੀ ਭਾਸ਼ਾ ਦੇ ਬਿਨਾਂ ਅਸੀਂ ਕੁਛ ਵੀ ਨਹੀਂ ਆਪਣੇ ਪੰਜਾਬ ਬਾਰੇ ਪਤਾ ਕਰ ਸਕਦੇ ਸਾਡੀ ਇਸ ਲਈ ਸਾਡੇ ਬਹੁਤ ਮੁੱਖ ਭੂਮਿਕਾ ਸਾਡੇ ਸਾਡੇ ਪੰਜਾਬ ਦੀ ਇਹ ਪੰਜਾਬੀ ਭਾਸ਼ਾ ਮੁੱਖ ਭੂਮਿਕਾ ਨਿਭਾਉਂਦੀ ਹੈ